ਹੈਲੋ ਸਤਿ ਸ਼੍ਰੀ ਅਕਾਲ ਜੀ ਸਨੀ ਢਾਬੇ ਤੋਂ ਬੋਲਦੇ ਹੋ ਜੀ ਤੁਸੀਂ ਦਸ ਮਿਨਟ ਪਹਿਲਾਂ ਆਪਣੀ ਗੱਲ ਹੋਈ ਸੀ ਜਿਹਦੇ ਵਿੱਚ ਮੈਂ ਦੋ ਸਬਜ਼ੀਆਂ ਅਤੇ ਵੀਹ ਰੋਟੀਆਂ ਔਡਰ ਕੀਤੀਆਂ ਸੀ ਕਿਉਂਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਘਰ ਆਉਣਾ ਸੀ ਅਤੇ ਹੁਣ ਮੈਨੂੰ ਲੱਗ ਰਿਹਾ ਹੈ ਕਿ ਰੋਟੀ ਨਾ ਕਿਤੇ ਘੱਟ ਪੈ ਜਾਵੇ ਹੁਣ ਚ ਮ ਮੈਂ ਹੁਣ ਚਾਹੁੰਦੀ ਹਾਂ ਕਿ ਦਸ ਰੋਟੀਆਂ ਤੁਸੀਂ ਜ਼ਿਆਦਾ ਪੈਕ ਕਰ ਦਿਓ ਅਤੇ ਇੱਕ ਸਬਜ਼ੀ ਹੋਰ ਪੈਕ ਕਰ ਦਿਓ ਪਹਿਲਾਂ ਵਾਲੇ ਔਡਰ ਦੀ ਪੇਮੈਂਟ ਮੈਂ ਕਰ ਦਿੱਤੀ ਸੀ ਅਤੇ ਹੁਣ ਦੀ ਪੇਮੈਂਟ ਮੈਂ ਔਡਰ ਹੋਣ ਤੋਂ ਬਾਅਦ ਕਰ ਦੇਵਾਂਗੀ ਤੁਹਾਡੀ ਡਿਲੀਵਰੀ ਬਹੁਤ ਵਧੀਆ ਹੁੰਦੀ ਹੈ ਅਤੇ ਮੇਰੇ ਘਰਦਿਆਂ ਨੂੰ ਤੁਹਾਡੇ ਢਾਬੇ ਦਾ ਖਾਣਾ ਬਹੁਤ ਵਧੀਆ ਲੱਗਦਾ ਹੈ ਅਤੇ ਅਸੀਂ ਹਰ ਵਾਰੀ ਤੁਹਾਡੇ ਤੁਹਾਡੇ ਢਾਬੇ ਤੋਂ ਹੀ ਮੰਗਵਾਉਂਦੇ ਹਨ ਅਤੇ ਚਲੋ ਠੀਕ ਹੈ ਜੀ ਤੁਸੀਂ ਮੇਰਾ ਔਡਰ ਟਾਈਮ ਨਾਲ ਪਹੁੰਚਾ ਦਿਓ